ਵੈਸੇ ਤਾਂ ਪੰਜਾਬ 'ਚ ਹਰ ਇੱਕ ਧਰਮ ਦੇ ਲੋਕ ਵਸਦੇ ਹਨ ਪਰ ਹਿੰਦੂ ਅਤੇ ਸਿੱਖ ਜ਼ਿਆਦਾਤਰ ਹਨ ਮੈਂ ਇੱਕ ਸਿੱਖ ਫੈਮਲੀ ਤੋਂ ਬਿਲੋਂਗ ਕਰਦੀ ਹਾਂ ਤਾਂ ਮੈਨੂੰ ਉਹਨਾਂ ਦਾ ਸੱਭਿਆਚਾਰ ਜ਼ਿਆਦਾ ਪਤਾ ਹੈ ਜਿਵੇਂ ਸਾਡਾ ਸੱਭਿਆਚਾਰ ਸਾਡਾ ਰਾਜ ਇਤਿਹਾਸ ਅਤੇ ਮੈਂ ਮੈਂ ਅਤੇ ਬਾਕੀ ਲੋਕ ਵੀ ਉਹ ਤੋਂ ਕਿਵੇਂ ਪ੍ਰਭਾਵਿਤ ਨੇ ਸਾਡੇ ਦਸ ਗੁਰੂ ਜਿਵੇਂ ਸਾਡੇ ਪਹਿਲੇ ਗੁਰੂ ਗੂਰੂ ਨਾਨਕ ਦੇਵ ਜੀ ਜਿਹਨਾਂ ਨੇ ਪੂਰੀ ਦੁਨੀਆਂ ਜਿਹੜੀ ਸੀ ਉਹ ਪੈਦਲ ਚੱਲ ਕੇ ਗਾਹ ਤੀ ਸੀ ਅਤੇ ਉਹਨਾਂ ਨੇ ਹਰੇਕ ਜਗ੍ਹਾ ਲੋਕਾਂ ਨੂੰ ਚੰਗੀਆਂ ਗੱਲਾਂ ਦੱਸੀਆਂ ਸਨ ਉਹ ਕਿਸੇ ਵੀ ਧਰਮ ਦਾ ਭੇਦਭਾਵ ਨਹੀਂ ਸੀ ਕਰਦੇ ਉਹ ਕਿਸੇ ਦੇ ਵੀ ਘਰ ਰੋਟੀ ਖਾ ਲੈੈਂਦੇ ਸੀ ਅਤੇ ਕਿਸੇ ਕਿਸੇ ਨਾਲ ਵੀ ਭੇਦਭਾਵ ਨਹੀਂ ਸੀ ਹੋਣ ਦਿੰਦੇ ਅਤੇ ਨਾ ਹੀ ਕਦੇ ਕਿਸੇ ਨਾਲ ਗਲਤ ਕਰਦੇ ਸੀ ਬੇਈਮਾਨੀ ਉਹਨਾਂ ਦੇ ਉਹਨਾਂ ਨੇ ਕਦੇ ਵੀ ਬੇਈਮਾਨੀ ਦੀ ਕਮਾਈ ਨਹੀਂ ਖਾਈ ਹਮੇਸ਼ਾਂ ਇਮਾਨਦਾਰੀ ਦੇ ਰਾਹ 'ਤੇ ਤੁਰੇ ਅਤੇ ਲੋਕਾਂ ਨੂੰ ਵੀ ਇਮਾਨਦਾਰੀ ਦੇ ਰਾਹ 'ਤੇ ਤੁਰਨਾ ਹੀ ਸਿਖਾਇਆ ਸਾਡੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਚਾਰ ਪੁੱਤਰ ਸਨ ਉਹਨਾਂ ਨੇ ਚਾਰੋ ਪੁੱਤਰ ਆਪਣੀ ਕੌਮ ਤੋਂ ਵਾਰ ਦਿੱਤੇ ਜਿਹਨਾਂ 'ਚ ਦੋ ਪੁੱਤਰ ਜਿਹਨਾਂ ਦੇ ਇੱਕ ਸਭ ਤੋਂ ਸਾਹਿਬਜ਼ਾਦਾ ਸ ਜਿਹੜੇ ਸਭ ਤੋਂ ਵੱਡੇ ਸਾਹਿਬਜ਼ਾਦੇ ਸੀ ਅਤੇ ਉਹਨਾਂ ਤੋਂ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹ ਚਮਕੌਰ ਦੀ ਲੜਾਈ ਜਿੱਥੇ ਚਾਲ੍ਹੀ ਲੱਖ ਫੌਜ ਔਰੰਗਜ਼ੇਬ ਨੇ ਭੇਜੀ ਹੋਈ ਸੀ ਉਹਨਾਂ ਫੌਜ਼ਾਂ ਨਾਲ ਉਹ ਦੋ ਸਾਹਿਬਜ਼ਾਦਿਆ ਨੇ ਲੜਾਈ ਕੀਤੀ ਅਤੇ ਆਖਿਰਕਾਰ ਚਮਕੌਰ ਦੀ ਗੜੀ ਵਿੱਚ ਉਹਨਾਂ ਨੇ ਸ਼ਹੀਦੀ ਪਾ ਲਿੱਤੀ ਅਤੇ ਜਿਹੜੇ ਸਭ ਤੋਂ ਛੋਟੇ ਸਾਡੇ ਦੋ ਸਾਹਿਬਜ਼ਾਦੇ ਅਤੇ ਦਾਦੀ ਮਾਂ ਜਿਹੜੇ ਠੰਢੇ ਬੁਰਜ ਵਿੱਚ ਕੈਦ ਕੀਤੇ ਹੋਏ ਸਨ ਔਰੰਗਜ਼ੇਬ ਨੇ ਉਹਨਾਂ ਨੂੰ ਦੀਵਾਰਾਂ 'ਚ ਚਿਣਵਾ ਦਿੱਤਾ ਫਿਰ ਵੀ ਉਹ ਛੋਟੇ ਸਾਹਿਬਜ਼ਾਦੇ ਇੰਨੇ ਛੋਟੇ ਹੋਣ ਦੇ ਬਾਵਜੂਦ ਇੱਕ ਅੱਠ ਸਾਲ ਅਤੇ ਦੂਜਾ ਦਸ ਸਾਲ ਦਾ ਉਹਨਾਂ ਨੇ ਜਮਾਂ ਵੀ ਨਹੀ ਸੀ ਡੋਲੇ ਅਤੇ ਪੂਰੀ ਬਹਾਦਰੀ ਨਾਲ ਔਰੰਗਜ਼ੇਬ ਦਾ ਸਾਹਮਣਾ ਕੀਤਾ ਉਹਨਾਂ ਦੀ ਦਾਦੀ ਜੀ ਬੁਰਜ ਵਿੱਚ ਹੀ ਬੈਠੇ ਰੱਬ ਨੂੰ ਪਿਆਰੇ ਹੋ ਗਏ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹਨਾਂ ਨੇ ਕਸ਼ਮੀਰੀ ਪੰਡਤਾਂ ਕਰਕੇ ਆਪਣੇ ਉਹਨਾਂ ਦੇ ਸਹਿਮਤੀ ਵਿੱਚ ਬੋਲੇ ਸਨ ਤਾਂ ਉਹਨਾਂ ਨੇ ਲਾਲ ਕਿਲ੍ਹਾ ਦਿੱਲੀ ਆਖਰੀ ਸਾਹ ਲਿੱਤੇ ਸਨ ਅਤੇ ਉਹਨਾਂ ਦੀ ਕੌ ਕੌਮ ਲਈ ਆਪਣਾ ਸਿਰ ਕਟਵਾ ਦਿੱਤਾ ਸੀ ਅਤੇ ਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਇੱਕ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਇਸ ਤਰ੍ਹਾਂ ਸਾਡੇ ਦਸਵੇਂ ਗੁਰੂ ਜੀ ਦੇ ਸਾਰੇ ਪਰਿਵਾਰ ਨੇ ਸ਼ਹੀਦੀ ਪਾ ਲਈ ਸਾਡੇ ਸਾਡੇ ਸੱਭਿਆਚਾਰ ਵਿੱਚ ਬਹੁਤ ਤਰੀਕੇ ਦੇ ਲੋਕ ਆਏ ਜਿਵੇਂ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਸਾਡੇ ਸੱਭਿਆਚਾਰ ਵਿੱਚ ਜਾਂ ਸਾਡਾ ਇਤਿਾਹਸ ਜਿਹਨੂੰ ਕਹਿ ਸਕਦੇ ਹਾਂ ਸਾਡਾ ਇਤਿਹਾਸ ਇਹੀ ਸੀ ਕਿ ਸਾਡਾ ਜਿਹੜਾ ਰਾਜਾ ਸੀ ਉਸਨੂੰ ਕਿਸੇ ਨੇ ਕਹਿ ਤਾ ਸੀ ਕਿ ਤੁਹਾਡਾ ਜਿਹੜਾ ਪਟਿਆਲਾ ਹੈ ਉਹ ਡੁੱਬ ਜਾਵੇਗਾ ਤਾਂ ਉਸ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਉਹ ਕੋਈ ਮਾਤਾ ਕੋਲਕਾਤਾ ਵਿੱਚ ਰਹਿੰਦੀ ਹੈ ਜਿਹਨੂੰ ਆਪਾਂ ਹੁਣ ਕਾਲੀ ਮਾਤਾ ਦੇ ਨਾਮ ਨਾਲ ਜਾਣਦੇ ਹਾਂ ਅਤੇ ਉਹਨੂੰ ਉੱਥੋਂ ਲੈ ਆਉ ਤਾਂ ਪਟਿਆਲਾ ਡੁੱਬਣ ਤੋਂ ਬਚ ਸਕਦਾ ਹੈ ਤਾਂ ਰਾਜਾ ਜੀ ਉਹਨੂੰ ਉੱਥੋਂ ਲੈ ਕੇ ਆਏ ਪਰ ਮਾਤਾ ਜੀ ਦੀ ਇਹ ਸ਼ਰਤ ਸੀ ਕਿ ਉਹ ਰਾਜਾ ਦੇ ਕਿਲ੍ਹਾ ਵਿੱਚ ਕਿਲ੍ਹੇ ਵਿੱਚ ਨਹੀਂ ਰਹੇਗੀ ਸਾਡੇ ਜਿਹੜੇ ਪਟਿਆਲੇ ਦੇ ਰਾਜਾ ਸੀ ਉਹਨਾਂ ਦਾ ਨਾਮ ਸੀ ਭੁਪਿੰਦਰ ਸਿੰਘ ਤਾਂ ਉਹ ਉੱਥੋਂ ਉਹਨਾਂ ਨੂੰ ਲੈ ਆਏ ਅਤੇ ਜਦੋਂ ਉਹ ਮਾਤਾ ਜੀ ਨੂੰ ਪਟਿਆਲੇ ਲੈ ਕੇ ਆਏ ਜਿਵੇਂ ਹੀ ਮਾਤਾ ਜੀ ਉਸ ਸਤਾਨ ਸਥਾਨ 'ਤੇ ਆ ਕੇ ਬੈਠੇ ਤਾਂ ਉਹ ਪੱਥਰ ਦੇ ਬਣ ਗਏ ਅਤੇ ਉਹ ਉੱਥੇ ਹੀ ਵਿਰਾਜਮਾਨ ਹੋ ਗਏ ਤਾਂ ਉੱਥੇ ਇੱਕ ਬਹੁਤ ਵੱਡਾ ਪ੍ਰਸਿੱਧ ਮੰਦਰ ਬਣ ਗਿਆ ਜਿੱਥੇ ਲੋਕ ਪੂਜਾ ਕਰਦੇ ਹਨ ਕਾਲੀ ਮਾਤਾ ਦੀ ਅਤੇ ਜਿਸ ਨੂੰ ਅੱਜ ਕਾਲੀ ਮਾਤਾ ਪ੍ਰਸਿੱਧ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸੀ ਸਾਡਾ ਇਤਿਹਾਸ ਅਤੇ ਸਾਡੇ ਧਰਮ ਦੀ ਰਾਜ ਸੱਭਿਆਚਾਰ ਇਸ ਤਰੀਕੇ ਨਾਲ ਮੈਂ ਆਪਣੀ ਕੌਮ ਤੋਂ ਬਹੁਤ ਪ੍ਰਭਾਵਿਤ ਹਾਂ ਕਿ ਜੇ ਉਹ ਛੋਟੇ ਬੱਚਿਆਂ ਨੇ ਇੱਕ ਕੌਮ ਲਈ ਆਪਣੀ ਜਾਨਾਂ ਗਵਾ ਦਿੱਤੀਆਂ ਸ਼ਹੀਦੀਆਂ ਪਾ ਲਿੱਤੀਆਂ ਤਾਂ ਅਸੀਂ ਵੀ ਕਿਸੇ ਤੋਂ ਕਿਉਂ ਡਰੀਏ ਅਤੇ ਅਸੀਂ ਵੀ ਕਿਸੇ ਦਾ ਅਹਿਸਾਨ ਸਾਨ ਕਿਉਂ ਲਈਏ ਕਿਸੇ ਸਾਡੀ ਕੌਮ ਸਾਨੂੰ ਇਹੀ ਸਿਖਾਉਂਦੀ ਹੈ ਕਿ ਸਾਨੂੰ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ ਅਤੇ ਮਾੜੇ ਬੰਦੇ ਅੱਗੇ ਤਾਂ ਬਿਲਕੁਲ ਵੀ ਨਹੀਂ ਅਤੇ ਕਿਸੇ ਦਾ ਜ਼ੁਲਮ ਨਹੀਂ ਸਹਿਣਾ ਚਾਹੀਦਾ ਅਤੇ ਨਾਂ ਹੀ ਕਿਸੇ 'ਤੇ ਜ਼ੁਲਮ ਕਰਨਾ ਚਾਹੀਦਾ ਹੈ